ਮੋਹਾਲੀ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਡਿਵੈਲਪਮੈਂਟ ਜੋ ਹੋ ਰਹੀ ਹੈ ਜੋ ਵਿਕਾਸ ਹੋ ਰਿਹਾ ਇਸ ਏਰੀਏ ਦਾ ਇਸ ਇਲਾਕੇ ਦਾ ਉਹ ਹੈ ਸਕੂਲਿੰਗ ਯੂਨੀਵਰਸਿਟੀ ਔਰ ਹੋਸਪੀਟਲਜ਼ ਬਹੁਤ ਜ਼ਿਆਦਾ ਮਤਲਬ ਡਿਵੈਲਪ ਹੋ ਰਹੇ ਹੈ ਅਤੇ ਉਸ ਤੋਂ ਇਲਾਵਾ ਔਰਤਾਂ ਨੂੰ ਜਿੱਦਾਂ ਕੁੜੀਆਂ ਨੂੰ ਸਕੂਲ 'ਚ ਛੂਟ ਹੁੰਦੀ ਹੈ ਫ਼ੀਸ ਵਗੈਰਾ 'ਚੋਂ ਕਾਲੇਜਿਸ 'ਚ ਔਰ ਇਸ ਤੋਂ ਇਲਾਵਾ ਮੋਹਾਲੀ ਜ਼ਿਲ੍ਹਾ ਜਿਹੜਾ ਸਾਰਾ ਇਹ ਕੰਡੀ ਇਲਾਕਾ ਹੈ ਇਸ 'ਚ ਗਵਰਮੈਂਟ ਜੌਬਸ 'ਚ ਮਤਲਬ ਕਾਫ਼ੀ ਸਾਨੂੰ ਛੂਟ ਹੋ ਜਾਂਦੀ ਹੈ ਕਾਫ਼ੀ ਚੀਜ਼ਾਂ 'ਚ ਜੋ ਸਾਨੂੰ ਸਾਡੇ ਲਈ ਉਹ ਬਹੁਤ ਬੈਨੀਫਿੱਟ ਹੁੰਦੀ ਹੈ ਉਹ ਚੀਜ਼ ਨਾ